ਸਤਿ ਸ਼੍ਰੀ ਅਕਾਲ ਜੀ ਮੈਂ ਤਨਵੀਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹਾਂ ਮੈਨੂੰ ਇੱਕ ਦਿੱਕਤ ਦੀ ਪਰੇਸ਼ਾਨੀ ਸਾਮਨੇ ਕੀਤੀ ਜਾ ਰਹੀ ਹੈ ਮੈਂ ਲੁਧਿਆਣੇ ਤੋਂ ਉੱਠ ਕੇ ਦਿੱਲੀ ਵਿੱਚ ਆ ਗਿਆ ਹਾਂ ਮੈਂ ਆਪਣਾ ਸ਼ਹਿਰ ਚੇਂਜ ਕਰ ਲਿਆ ਹੈ ਕਿਉਂਕੀ ਮੇਰੀ ਇਥੇ ਨੌਕਰੀ ਲੱਗ ਚੁੱਕੀ ਹੈ ਮੈਂ ਆਪਣੇ ਘਰੋਂ ਉੱਠ ਕੇ ਇੱਥੇ ਆ ਗਿਆ ਹਾਂ ਤੇ ਮੈਂ ਕਿਰਪਾ ਕਰਕੇ ਤੁਹਾਨੂੰ ਬੇਨਤੀ ਕੀਤਾ ਜਾਂਦਾ ਹਾਂ ਕੀ ਮੇਰਾ ਗੈਸ ਨੰਬਰ ਚਾਰ ਪੰਜ ਛੇ ਸੱਤ ਅੱਠ ਨੌ ਹੈ ਇਹਨੂੰ ਇਹਦਾ ਐਡਰੈਸ ਅਪਡੇਟ ਕੀਤਾ ਜਾਵੇ ਮੇਰਾ ਐਡਰੈਸ ਨੰਬਰ ਤਿਲਕ ਨਗਰ ਨਿਊ ਦਿੱਲੀ ਹੈ ਇੱਥੇ ਮੇਰਾ ਐਡਰੈਸ ਅਪਡੇਟ ਕਰ ਦਿੱਤਾ ਜੋ ਸੋ ਤਾਂ ਕਿ ਮੈਨੂੰ ਜੇ ਕੱਲ ਨੂੰ ਗੈਸ ਦਾ ਕੋਈ ਵੀ ਸਲੰਡਰ ਲੈਣਾ ਹੋਵੇ ਤੇ ਮੈਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਹਟ ਕੇ ਮੈਂ ਆਰਾਮ ਨਾਲ ਗੈਸ ਲੈ ਸਕਾਂ ਤਾਂ ਕਿ ਮੈਂ ਆਰਾਮ ਨਾਲ ਰੋਟੀ ਪਾਣੀ ਬਣਾ ਸਕਾਂ ਤੇ ਇਹ ਕਿਰਪਾ ਕਰਕੇ ਮੇਰਾ ਆਹ ਕੰਮ ਕਰਾ ਦਿੱਤਾ ਜਾਵੇ ਤਾਂ ਕਿ ਮੈਂ ਕਿਸੇ ਵੀ ਪਰੇਸ਼ਾਨੀ ਹੇਠ ਨਾ ਫਸਾ ਮੈਂ ਤੁਹਾਨੂੰ ਪਹਿਲਾਂ ਹੀ ਹਦਾਇਤ ਦੇ ਰਿਹਾ ਹਾਂ ਕਿ ਮੈਂ ਆਪਣਾ ਜਿਲਾ ਚੇਂਜ ਕਰ ਲਿਆ ਹੈ ਲੁਧਿਆਣੇ ਤੋਂ ਉੱਠ ਕੇ ਮੈਂ ਇੱਥੇ ਆ ਗਿਆ ਵਾਂ ਆਹ ਦਿੱਲੀ ਦੇ ਵਿੱਚ